ਹੈਲੋ ਦਲਜਿੰਦਰ ਸਿੰਘ ਜੀ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਪਛਾਣਿਆ ਜੀ ਹਾਂਜੀ ਹਾਂਜੀ ਹਾਂਜੀ ਸਰ ਆਪਾਂ ਦਰਬਾਰ ਸਾਹਿਬ ਮਿਲੇ ਸੀ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਜੀ ਅਤੇ ਹੋਰ ਜੀ ਬਾਲ ਬੱਚੇ ਠੀਕ ਆ ਸਰ ਜੀ ਹਾਂਜੀ ਹਾਂਜੀ ਵਧੀਆ ਹਾਂਜੀ ਹਾਂਜੀ ਵਧੀਆ ਅਤੇ ਜੀ ਅਸੀਂ ਨਾ ਤੁਹਾਡੇ ਤੋਂ ਇੱਕ ਇਹ ਚੀਜ਼ ਪੁੱਛਣੀ ਸੀਗੀ ਆਪਣਾ ਤੁਹਾਨੂੰ ਪਤਾ ਹੀ ਆ ਜੀ ਹੁਣ ਮੈਂ ਤਾਂ ਕੰਮ ਕਾਰ ਚਲਾ ਜਾਂਦਾ ਜੀ ਅਤੇ ਹੁਣ ਗਾਂਹ ਨਾ ਘਰਦਿਆਂ ਨੂੰ ਔਖਾ ਹੋ ਜਾਂਦਾ ਵੀ ਸਬਜ਼ੀ ਵਗੈਰਾ ਦਾ ਲਿਆਉਣਾ ਕਰਨਾ ਕੋਲ ਅਤੇ ਨੇੜੇ ਕੋਈ ਸਬਜ਼ੀ ਵਾਲਾ ਹੋਵੇ ਅੱਡਾ ਜੀ ਕੋਈ ਮੰਨ ਕੇ ਚਲੋ ਕੋਈ ਹੋਰ ਗਲੀ ਚ ਆਉਂਦਾ ਹੋਵੇ ਮੈਨੂੰ ਥੋੜ੍ਹਾ ਚਾਨਣਾ ਪਾਓ ਅਤੇ ਫਿਰ ਆਪਣਾ ਵੀ ਦਿੱਕਤ ਨਾ ਆਵੇ ਕੋਈ ਆਪਾਂ ਨੂੰ ਇੱਦਾਂ ਦੀ ਕੋਈ ਨਹੀਂ ਨਹੀਂ ਕੰਮ ਨਹੀਂ ਕਰਕੇ ਦੇ ਦੇਣਾ ਜੀ ਕਿਉਂਕਿ ਨਾ ਜੀ ਫਿਰ ਹਾਂਜੀ ਹਾਂਜੀ ਘਰੇ ਫਿਰ ਨਾ ਤੁਹਾਨੂੰ ਪਤਾ ਈ ਐ ਜੀ ਨਿਕਲਣਾ ਕਰਨਾ ਫਿਰ ਘਰ ਵਾਲਿਆਂ ਨੂੰ ਔਖਾ ਹੋ ਜਾਂਦਾ ਜੀ ਥੋੜ੍ਹਾ ਜੀ ਘਰੇ ਤੁਹਾਨੂੰ ਪਤਾ ਹੀ ਫਿਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਉਹੀ ਤਾਂ ਗੱਲ ਨਾ ਜੀ ਤੁਹਾਨੂੰ ਪ ਤੁਹਾਨੂੰ ਪਤਾ ਹੀ ਅਸੀਂ ਤਾਂ ਹੁਣ ਨਵੇਂ ਆਏ ਨਾ ਇੱਥੇ

ਅੱਛਾ ਜੀ ਉਹੀ ਤਾਂ ਗੱਲ ਆ ਜੀ ਇਸ 'ਤੇ ਇਸ 'ਤੇ ਕਲਰ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਪੈਸੇ ਪੂਰੇ ਦਿੰਦੇ ਹਾਂ ਜੀ ਆਪਾਂ ਅਤੇ ਫਿਰ ਚੀਜ਼ ਵੀ ਵਧੀਆ ਨਾ ਮਿਲੇ ਥੋੜ੍ਹਾ ਜਿਹਾ ਹਾਂਜੀ ਹਾਂਜੀ ਹਾਂਜੀ ਅਤੇ ਸਰ ਸਰ ਸਰ ਇੱਕ ਰਿਕੁਐਸਟ ਸੀ ਰਿਕੁਐਸਟ ਸੀ ਤੁਹਾਡੇ ਤੱਕ ਕਿ ਤੁਸੀਂ ਤੁਹਾਡੇ ਕੋਈ ਟਾਈਮ ਨਿਕਲੇ ਤਾਂ ਆਪਾਂ ਸਵੇਰੇ ਚੱਲ ਵੇਰੇ ਕਰੀਏ ਜੀ ਮੰਡੀ ਹਾਂਜੀ ਚਲੋ ਠੀਕ ਹੈ ਸਰ ਠੀਕ ਹੈ ਸਰ ਮਿਲਦੇ ਆ ਫਿਰ ਆਪਾਂ ਜੀ ਠੀਕ ਠੀਕ ਹੈ ਸਰ ਠੀਕ ਹੈ ਓਕੇ ਜੀ